ਇੱਕ ਅਗਸਤ ਉੱਨੀ ਸੌ ਸਤੱਤਰ ਉਣੱਤੀ ਨਵੰਬਰ ਦੋ ਹਜ਼ਾਰ ਛੇ ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਸੋਲ੍ਹਾਂ ਜਨਵਰੀ ਦੋ ਹਜ਼ਾਰ ਛੇ ਪੰਜ ਦਸੰਬਰ ਦੋ ਹਜ਼ਾਰ ਪੰਦਰ੍ਹਾਂ